ਹੈਲੋ ਨਮਸ਼ਕਾਰ ਜੀ ਹਾਂਜੀ ਹਾਂਜੀ ਅੱਛਾ ਜੀ ਨਹੀਂ ਮੈਮ ਅਸੀਂ ਤਾਂ ਆਪਦੇ ਵੱਲੋਂ ਸਾਰੇ ਬੱਚਿਆਂ ਨੂੰ ਇੱਕੋਂ ਜਿੰਨਾ ਕਰਵਾਨੇ ਹਾਂ ਕੋਸ਼ਿਸ਼ ਕਰ ਰਏ ਮੈਡਮ ਪ੍ਰੈਕਟਿਸ ਕਰਨੀ ਪੈਂਦੀ ਹੈ ਬੱਚਾ ਕਿੰਨੀ ਪ੍ਰੈਕਟਿਸ ਕਰਦਾ ਹੈ ਮੈਮ ਸਾਡੇ ਕੋਲ ਜਿੰਨੀ ਦੇਰ ਬੈਠਦਾ ਹੈ ਅਸੀਂ ਤਾਂ ਪੂਰੀ ਕਲਾਸ ਦੇ ਵਿੱਚ ਪੂਰਾ ਡਿਸਿਪਲਿਨ ਦੇ ਨਾਲ ਰੱਖਦੇ ਹਾਂ ਕੋਈ ਇਹੋ ਜਿਹਾ ਹੈ ਹੀ ਨਹੀਂ ਕਿ ਬੱਚਾ ਡਿਸਟਰਬੇਨਸ ਕ ਤੋ ਉਹ ਨਹੀਂ ਉਹ ਕੋਈ ਗੱਲ ਨਹੀਂ ਉਹਨੂੰ ਅੱਗੇ ਬਿਠਾ ਲਾਂਗੇ ਉਹ ਤਾਂ ਬੱਚਾ ਜਿੱਥੇ ਆਉਂਦਾ ਆਪੇ ਆ ਕੇ ਬੈਠ ਜਾਂਦੇ ਹੈ ਕੋਈ ਰੋਲ ਨੰਬਰ ਵਾਈਸ ਕੋਈ ਇਹੋ ਜਿਹਾ ਸਿਸਟਮ ਤਾਂ ਹੈ ਨਹੀਂ ਸਾਡੇ ਕੋਲ ਕੀ ਪੀ ਸਾਰੇ ਬੱਚਿਆਂ ਨੇ ਮੈਮ ਮੈਡਮ ਉਨ੍ਹਾਂ ਨੂੰ ਸਾਲ ਹੋ ਗਿਆ ਆਉਂਦਿਆਂ ਨੂੰ ਚਲੋ ਕਰਦੇ ਹਾਂ ਧਿਆਨ ਦਿਆਂਗੇ ਤੁਹਾਡੀ ਗੱਲ ਦਾ ਤੁਹਾਨੂੰ ਦੁਬਾਰਾ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਆਏਗਾ ਠੀਕ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ